ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਸ ਵਧੀਆ ਜੀ ਹੋਰ ਤੁਸੀਂ ਸੁਣਾਓ

ਹਾਂਜੀ ਦੱਸੋ ਹਾਂਜੀ ਹਾਂਜੀ ਹਾਂਜੀ ਠੀਕ ਹਾਂਜੀ ਹਾਂਜੀ ਹਾਂਜੀ ਠੀਕ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਮੇਰੇ ਕੋਲ਼ ਬਹੁਤ ਸਾਰੀ ਮੂਵੀਜ਼ ਵੀ ਪਈਆਂ ਮੈਂ ਡਾਊਨਲੋਡ ਵੀ ਕੀਤੀਆਂ ਹੋਈਆਂ ਫੋਨ 'ਚ ਪਈਆਂ ਹੋਈਆਂ ਮੇਰੇ ਤੁਹਾਨੂੰ ਕਿਹੜੀ ਕਿੱਦਾਂ ਦੀ ਚਾਹੀਦੀ ਆ ਤੁਹਾਨੂੰ ਹਾਂਜੀ ਜਿੱਦਾਂ ਮਤਲਬ ਹੋਲੀਵੁੱਡ ਵੀ ਚਾਹੀਦਾਂ ਕਿ ਕੱਲੀ ਬੋਲੀਵੁੱਡ ਹੀ ਚਾਹੀਦੀਆਂ ਠੀਕ ਹੈ ਹਾਂਜੀ ਹਾਂਜੀ ਜਿਵੇਂ ਹਾਂਜੀ ਇੱਕ ਦਿਲ ਦਿਲਜੀਤ ਦੋਸਾਂਝ ਦੀ ਆਈ ਹੈ ਅਤੇ ਗਿੱਪੀ ਗਰੇਵਾਲ ਦੀ ਹੈਗੀਆਂ ਦੋ ਤਿੰਨ ਫਿਲਮਾਂ ਅਤੇ ਘੁੱਗੀ ਦੀ ਹੈਗੀ ਹੈ ਜਸਵਿੰਦਰ ਭੱਲਾ ਇਹ ਹੈਗੀ ਹੈ ਕਲਾਕਾਰ ਪੰਜਾਬੀ ਕਲਾਕਾਰ ਦੀਆਂ ਜਿਨ੍ਹਾਂ ਦੀ ਹੁਣ ਪੰਜਾਬੀ ਮੂਵੀ ਲੇਟੈਸਟ ਆਈਆਂ ਹੋਈਆਂ ਏ ਹੁਣੀਆਂ ਹੁਣੇ ਹੁਣੇ ਆਈਆਂ ਉਹਨਾਂ ਦੀਆਂ ਹਾਂਜੀ ਤਾਂ ਤੁਹਾਨੂੰ ਚਾਹੀਦੀਆਂ ਤਾਂ ਫਿਰ ਮੈਂ ਆਪਣੇ ਫੋਨ ਤੋਂ ਮੈਂ ਤੁਹਾਨੂੰ ਭੇਜ ਦਵਾਂਗੀ

ਦਿਲਜੀਤ ਦੋਸਾਂਝ ਹੋ ਗਿਆ ਉਹ ਹੁਣੇ ਕ ਕਾਫੀ ਕਾਫੀ ਜ਼ਿਆਦਾ ਫੇਮਸ ਹੋਇਆ ਵਿਆ ਏ ਜ਼ਿਆਦਾਤਰ ਪੰਜਾਬ 'ਚ ਕਾਫੀ ਉਹਦੇ ਗਾਣੇ ਚੱਲਦੇ ਆ ਨਵੇਂ ਨਵੇਂ ਅਤੇ ਗਿੱਪੀ ਗਰੇਵਾਲ ਦੀ ਹੁਣ ਨਵੀਂ ਫਿਲਮਾਂ ਆਈਆਂ ਜਸਵਿੰਦਰ ਭੱਲਾ ਦੀਆਂ ਆਈਆਂ ਉਹ ਹਸਾੜ ਵਿੱਚ ਕਾਫੀ ਜ਼ਿਆਦਾ ਉਹ ਹੈ ਹਸੀ ਮਜ਼ਾਕ ਕਰਨੇ ਵਿੱਚ ਘੁੱਗੀ ਵੀ ਇੱਦਾਂ ਦਾ ਹੀ ਹੈ ਘੁੱਗੀ ਘੁੱਗੀ ਵੀ ਕਾਫੀ ਉਹ ਹੈ ਹਸਾਣੇ ਵਿੱਚ ਤਾਂ ਤੁਸੀਂ ਦੱਸੋ ਤਾਂ ਤੁਹਾਨੂੰ ਤੁਸੀਂ ਦੱਸੋ ਕਿਹੜੀ ਚਾਹੀਦੀ ਹੈ ਤੁਹਾਨੂੰ

ਹਾਂਜੀ ਠੀਕ ਹੈ ਇੱਕ ਬਾਹੂਬਲੀ ਆਈ ਹੈ ਹਾਲੀਵੁੱਡ ਮੂਵੀ ਆਈ ਹੈ ਹੋਲੀਵਡ ਬਾਹੂਬਲੀ ਹੈ ਥਰੀ ਇਡੀਅਟਸ ਹੈ ਹਾਂਜੀ ਠੀਕ ਹੈ ਓਕੇ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਜੀ